ਹੈਲੋ ਸਰ ਸਵੀਗੀ ਤੋਂ ਗੱਲ ਕਰ ਰਹੇ ਹੋ ਮੈਂ ਰੁਪਿੰਦਰ ਗੱਲ ਕਰ ਰਹੀ ਹਾਂ ਬਠਿੰਡਾ ਤੋਂ ਮੈਂ ਹੁਣੇ ਸਾਢੇ ਕੁ ਚਾਰ ਵਜੇ ਤੁਹਾਨੂੰ ਇੱਕ ਔਡਰ ਕੀਤਾ ਸੀਗਾ ਜਿਹਦੇ 'ਚ ਬਰਗਰ ਨੂਡਲਸ ਅਤੇ ਪੀਜਾ ਔਡਰ ਕੀਤਾ ਸੀਗਾ ਅਤੇ ਸਾਢੇ ਚਾਰ ਵਜੇ ਤੋਂ ਮਤਲਬ ਤੁਸੀਂ ਕਿਹਾ ਸੀ ਪੰਜ ਵਜੇ ਤੱਕ ਔਡਰ ਤੁਹਾਡੇ ਕੋਲ ਪਹੁੰਚ ਜਾਊਗਾ ਸਾਡੇ ਘਰ ਗੈਸਟ ਆਏ ਹੋਏ ਆ ਔਡਰ ਵੀ ਤੁਹਾਡਾ ਪੰਜ ਵਜੇ ਪਹੁੰਚਿਆ ਨਹੀਂ ਸਵਾ ਪੰਜ ਵਜੇ ਪਹੁੰਚਿਆ ਅਤੇ ਉਹਨੂੰ ਜਦੋਂ ਖੋਲ੍ਹ ਕੇ ਦੇਖਿਆ ਅਸੀਂ ਉਹ 'ਚ ਇੰਨੀ ਗੰਦੀ ਸਬਜ਼ੀਆਂ ਦੀ ਸਮੈਲ ਆ ਰਹੀ ਸੀ ਘਰ 'ਚ ਸਾਡੇ ਗੈਸਟ ਆਏ ਹੋਏ ਆ ਮੈਨੂੰ ਇੰਨੀ ਅੰਬੈਰ ਇੰਨੀ ਜ਼ਿਆਦਾ ਸ਼ਰਮਿੰਦਗੀ ਫੀਲ ਹੋਈ ਉਹਨਾਂ ਅੱਗੇ ਹੁਣ ਦੱਸੋ ਫਿਰ ਮੈਂ ਟਾਈਮ 'ਤੇ ਹੋਰ ਕਿਤੋਂ ਔਡਰ ਕੀਤਾ ਹੁਣ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਅਸੀਂ ਅੱਗੇ ਤੁਹਾਡੇ ਤੋਂ ਹੀ ਔਡਰ ਕਰਦੇ ਹੈਗੇ ਹਾਂ ਅਤੇ ਪਰ ਤੁਸੀਂ ਬਹੁਤ ਖ਼ਰਾਬ ਖਾਣਾ ਭੇਜਿਆ ਹੈਗਾ ਇਸ ਲਈ ਸਾਨੂੰ ਬਹੁਤ ਗੁੱਸਾ ਤੁਹਾਡੇ 'ਤੇ ਅਤੇ ਹੁਣ ਮੈਨੂੰ ਜਾਂ ਤਾਂ ਮੇਰੇ ਪੈਸੇ ਤੁਸੀਂ ਰਿਫੰਡ ਕਰ ਦਿਓ ਅਤੇ ਪੂਰੇ ਪੈਸੇ ਰਿਫੰਡ ਚਾਹੀਦੇ ਹੈਗੇ ਆ ਕਿਉਂਕਿ ਬਿਲਕੁਲ ਖ਼ਰਾਬ ਤੁਸੀਂ ਭੇਜਿਆ ਤੁਸੀਂ ਆਪ ਵੀ ਉਹ ਚੈੱਕ ਕਰ ਸਕਦੇ ਹੋ ਜੋ ਤੁਹਾਡਾ ਦੇ ਕੇ ਗਿਆ ਡਿਲੀਵਰ ਕਰਕੇ ਗਿਆ ਸਾਨੂੰ